ਤੁਸੀਂ ਢਿੱਲੋਂ ਹੋਟਲ ਵਿੱਚੋਂ ਬੋਲਦੇ ਹੋਂ ਅਤੇ ਮੈਂ ਇੱਥੇ ਖਾਣੇ ਦਾ ਆਡਰ ਕਰਨਾ ਸੀ ਮੈਨੂੰ ਚਿੱਲੀ ਚਿਕਨ ਅਤੇ ਰੋਟੀਆਂ ਮੰਗਵਾਉਣੀਆਂ ਸਨ ਕੀ ਤੁਸੀਂ ਭੇਜ ਸਕਦੇ ਹੋ ਅੱਜ ਏ ਸ਼ਾਮ ਦੇ ਛੇ ਕੁ ਵਜੇ ਤੱਕ ਤੁਸੀਂ ਜੇ ਭੇਜ ਦਿਓ ਤਾਂ ਵਧੀਆ ਰਹੇਗਾ ਅਤੇ ਤੁਸੀਂ ਇਹਦੇ ਵਿੱਚੋਂ ਕੋਈ ਛੂਟ ਦੇ ਸਕਦੇ ਹੋ ਮੈਨੂੰ ਹਾਂਜੀ ਠੀਕ